ਮੇਰੀ ਮਨਪਸੰਦ ਫੋਟੋ ਜੋ ਕਿ ਅਪੇਰਾ ਹਾਊਸ ਆਸਟ੍ਰੇਲੀਆ ਤੋਂ ਦੇ ਬਾਹਰ ਲਈ ਗਈ ਸੀ ਇਹ ਉਦੋਂ ਦੀ ਗੱਲ ਹੈ ਜਦੋਂ ਅਸੀਂ ਦੋ ਸਾਲ ਪਹਿਲਾਂ ਆਸਟ੍ਰੇਲੀਆ ਘੁੰਮਣ ਗਏ ਸੀ

ਸਿਡਨੀ ਤੋਂ ਹੁੰਦੇ ਹੋਏ ਅਸੀਂ ਅਪੇਰਾ ਹਾਊਸ ਪਹੁੰਚੇ ਉੱਥੇ ਘੁੰਮ ਫਿਰ ਕੇ ਅਸੀਂ ਉਹ ਫੋਟੋ ਲਈਆਂ ਉਹਨਾਂ ਵਿੱਚੋਂ ਕੁਛ ਫੋਟੋਆਂ ਮੇਰੇ ਮਨਪਸੰਦ ਦੀਆਂ ਫੋਟੋਆਂ ਬਣ ਗਈਆਂ